ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਮੈਂ ਇਬਾਦਤ ਦੀ ਮੰਮਾ ਬੋਲਦੀ ਸੀ ਹਾਂਜੀ ਸਰ ਮੈਂ ਤਾਂ ਕੋਲ ਕੀਤੀ ਸੀਗੀ ਮੈਂ ਇਹ ਪੁੱਛਣਾ ਸੀ ਅੱਜ ਕੁਛ ਤੁਸੀਂ ਇਮਪੋਰਟੈਂਟ ਵਰਕ ਤਾਂ ਨਹੀਂ ਕਰਵਾਉਣਾ ਸੀਗਾ ਉਹ ਬਿਮਾਰ ਸੀਗੀ ਉਹ ਅੱਜ ਆ ਨਹੀਂ ਸਕਦੀ ਸਕੂਲ ਹਾਂਜੀ ਹਾਂਜੀ ਐਕਚੁਅਲੀ ਉਹ ਰੋ ਰਹੀ ਸੀ ਉਹ ਕਹਿੰਦੀ ਵੀ ਮੰਮਾ ਮੈਂ ਜਾਣਾ ਸਕੂਲ ਵੀ ਮੈਨੂੰ ਸਰ ਕੁਛ ਕਹਿਣ ਨਾ ਤਾਂ ਕਰਕੇ ਮੈਂ ਕਿਹਾ ਚੱਲੋ ਵੀ ਇੱਕ ਵਾਰ ਮੈਂ ਗੱਲ ਕਰ ਲੈਂਦੀ ਹਾਂ ਵੀ ਇਵੇਂ ਤਾਂ ਕੋਈ ਗੱਲ ਨਹੀਂ ਹੈਗੀ ਅਤੇ ਜੇ ਕੋਆਰਡੀਨੇਟਰ ਮੈਮ ਨਾਲ ਗੱਲ ਕਰਨੀ ਆ ਤਾਂ ਮੈਂ ਉਹਨਾਂ ਨੂੰ ਵੀ ਕੋਲ ਕਰ ਦਿੰਦੀ ਹਾਂ ਤੁਸੀਂ ਮੈਨੂੰ ਇੱਕ ਵਾਰ ਦੱਸ ਦਿੰਦੇ ਹਾਂਜੀ ਬਾਕੀ ਮੈਂ ਹਾਂਜੀ ਹਾਂ ਬਾਕੀ ਨਾ ਮੈਂ ਔਨਲਾਈਨ ਲੀਵ ਅਪਲਾਈ ਕਰ ਦਿੱਤੀ ਸੀਗੀ ਬਾਕੀ ਜੇ ਰਿਟਨ ਦੇ ਵਿੱਚ ਵੀ ਭੇਜਣੀ ਆ ਤਾਂ ਮੈਂ ਇੱਧਰ ਸਾਡੇ ਘਰ ਦੇ ਕੋਲ ਜਿਹੜੇ ਬੱਚੇ ਆਉਂਦੇ ਨੇ ਪੜ੍ਹਦੇ ਨੇ ਤੁਹਾਡੇ ਸਕੂਲ 'ਚ ਉਹਨਾਂ ਕੋਲ ਭੇਜ ਦਿੰਦੇ ਹਾਂ ਤਾਂ ਤੁਸੀਂ ਮੈਨੂੰ ਦੱਸ ਦਿਓ ਜਿਵੇਂ ਵੀ ਹੋਇਆ ਹਾਂਜੀ ਹਾਂਜੀ ਬਾਕੀ ਮੈਂ ਇਹ ਪੁੱਛਣਾ ਸੀਗਾ ਬਾਕੀ ਠੀਕ ਕਰ ਰਹੀ ਆ ਕਲਾਸ ਦੇ ਵਿੱਚ ਮਤਲਬ ਧਿਆਨ ਵਧੀਆ ਦਿੰਦੀ ਹੈ ਇਵੇਂ ਤਾਂ ਨਹੀਂ ਹੈਗਾ ਹਾਂਜੀ ਹਾਂਜੀ ਮੈਂ ਉਹੀ ਪੁੱਛਣਾ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਸਰ ਮੈਂ ਇੱਕ ਪੁੱਛਣਾ ਸੀਗਾ ਵੀ ਪੇਰੈਂਟਸ ਟੀਚਰ ਮੀਟਿੰਗ ਇਸ ਸੈਟਰਡੇ ਹੀ ਆ ਕਿ ਨੈਕਸਟ ਸੈਟਰਡੇ ਹੋਵੇਗੀ ਹਾਂਜੀ ਹਾਂਜੀ ਠੀਕ ਹੈ ਸਰ ਬਾਕੀ ਸਰ ਹੋਰ ਕੋਈ ਫੋਰਮੈਲਟੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਉ ਹਾਂਜੀ ਹਾਂਜੀ ਅਤੇ ਸਰ ਇੱਕ ਮੈਂ ਪੁੱਛਣਾ ਇੱਕ ਹਾਂਜੀ ਹਾਂਜੀ ਇੱਕ ਮੈਂ ਇਨਕੁਆਇਰ ਕਰਨਾ ਸੀਗਾ ਜਿੱਦਾਂ ਤੁਹਾਡੀ ਕਲਾਸ 'ਚ ਕੋਈ ਬੱਚਾ ਹੈ ਅਤੇ ਉਹਦਾ ਨਾਮ ਦੀਪਾਨਸ਼ੂ ਆ ਉਹ ਕਹਿੰਦੀ ਸੀ ਕਿ ਉਹ ਮੈਨੂੰ ਕਾਫੀ ਤੰਗ ਕਰਦਾ ਹੈ ਥੋੜ੍ਹਾ ਜਿਹਾ ਤੁਸੀਂ ਉਹ ਵੀ ਧਿਆਨ ਰੱਖਿਓ ਹਾਂਜੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਠੀਕ ਹੈ ਸਰ ਮੈਂ ਤੁਹਾਨੂੰ ਮੇਲ ਕਰਤੀ ਚੈੱਕ ਕਰ ਲਿਓ ਜੀ ਓਕੇ ਓਕੇ ਥੈਂਕ ਯੂ ਸਰ